ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਫਾਈ ਰੱਖਣੀ ਚਾਹੀਦੀ ਹੈ ਆਪਣੇ ਆਲੇ ਦੁਆਲੇ ਕੋਈ ਗੰਦ ਨਹੀਂ ਹੋਣਾ ਚਾਹੀਦਾ ਗੰਦ 'ਚ ਮੱਛਰ ਬਣੇਗਾ ਕੂਲਰਾਂ 'ਚ ਹੋਰ ਬਾਲਟੀਆਂ 'ਚ ਪਾਣੀ ਨਹੀਂ ਜਮ੍ਹਾਂ ਕਰਕੇ ਚਾਹੀਦਾ ਗੰਦਾ ਪਾਣੀ ਜਮ੍ਹਾਂ ਕਰਕੇ ਰੱਖਣਾ ਚਾਹੀਦਾ ਕੋਈ ਆਪਣੇ ਕੋਈ ਜਾਮ ਨੇ ਸੀਵਰ ਵਗੈਰਾ ਕੁਛ ਜਿੱਥੇ ਪਾਣੀ ਬਹੁਤ ਜ਼ਿਆਦਾ ਜਮ੍ਹਾਂ ਮੀਂਹ ਦਾ ਪਾਣੀ ਖੜ੍ਹ ਜਾਂਦਾ ਕਈ ਵਾਰ ਟੱਬਾਂ 'ਚ ਆਪਣੇ ਆਪਾਂ ਗੌਰ ਹੀ ਨਹੀਂ ਕਰਦੇ ਉਤੋਂ ਗੰਦੇ ਪਾਣੀ ਤੋਂ ਮੱਛਰ ਬਣ ਜਾਂਦਾ ਅਤੇ ਥੋੜ੍ਹਾ ਜਾ ਸਰਕਾਰ ਨੂੰ ਵੀ ਅਵੇਅਰ ਕਰਨਾ ਚਾਹੀਦਾ ਚੰਗੀ ਤਰ੍ਹਾਂ ਵੀ ਆਹ ਚੀਜ਼ਾਂ ਹੋਣ ਹੈ ਨਾ ਆਪਣੀ ਡਾਈਟ ਸਭ ਤੋਂ ਵਧੀਆ ਹੋਣੀ ਚਾਹੀਦੀ ਆ ਜੇ ਆਪਣਾ ਇਮੀਊਨਟੀ ਤਗੜੀ ਆ ਤਾਂ ਆਪਾਂ ਬਿਮਾਰੀ ਨਾਲ ਲੜ ਸਕਦੇ ਹਾਂ ਨਾਰੀਅਲ ਪਾਣੀ ਪੀਏ ਹੈ ਨਾ ਡਰੈਗਨ ਫਰੂਟ ਖਾਈਏ ਸੇਬ ਸੂਬ ਖਾਈਏ ਆਪਣਾ ਹਾਜ਼ਮਾ ਵੀ ਕਿਉਂਕਿ ਜਦੋਂ ਡੇਂਗੂ ਹੁੰਦਾ ਹੈ ਇਹ ਸਿੱਧਾ ਲੀਵਰ ਨੂੰ ਵੀ ਅਸਰ ਕਰਦਾ ਬੁਖਾਰ ਦੇ ਨਾਲ ਨਾਲ ਬੰਦੇ ਦੇ ਖਾਣ ਪੀਣ 'ਤੇ ਵੀ ਅਸਰ ਪਾਉਂਦਾ ਇਹ ਚੀਜ਼ ਪਾਈਏ ਆਪਾਂ ਕੱਪੜੇ ਪੂਰੇ ਪਾ ਕੇ ਰੱਖੀਏ ਹੱਥਾਂ 'ਤੇ ਹੈ ਨਾ ਬਾਹਵਾਂ 'ਤੇ ਉਹ ਲਾ ਕੇ ਰੱਖੀਏ ਜਿਹੜੀ ਬਚਾਉਂਦੀਆਂ ਦਵਾਈਆਂ ਇਹ ਤੋੋਂ ਕਛੂਏ ਲਾ ਕੇ ਰੱਖੀਏ ਆਪਾਂ ਮਸ਼ੀਨਾਂ ਲਾ ਕੇ ਰੱਖੀਏ ਗੰਦ ਤੋਂ ਦੂਰ ਰਹੀਏ ਆਪਾਂ ਥੋੜ੍ਹਾ ਪਰਹੇਜ਼ ਕਰੀਏ ਵੀ ਜੇ ਕਿਤੇ ਆਪਣੇ ਗੰਦ ਹੈਗਾ ਤਾਂ ਆਪਾਂ ਚੁੱਕਵਾ ਦੀਏ ਉਹਨੂੰ ਐਂ ਨਹੀਂ ਵੀ ਨਾ ਗੈਲੀ ਕਰਕੇ ਪਿਆ ਹੀ ਰਹਿਣ ਦਿਉ ਕੋਈ ਨਾ ਆਪਣਾ ਕਿਹੜਾ ਹੈਗਾ ਉਹ ਆਪਣੇ ਲਈ ਨਹੀਂ ਚਲੋ ਬਿਮਾਰੀ ਜਿਹੜੀ ਹੋਣੀ ਆ ਫਿਰ ਉਹਨੇ ਇਹ ਨਹੀਂ ਦੇਖਣਾ ਵੀ ਆਪਣਾ ਬੇਗਾਨਾ ਉਹਨੇ ਤਾਂ ਫਿਰ ਆਪਾਂ ਨੂੰ ਘੇਰ ਹੀ ਲੈਣਾ ਅਤੇ ਧਿਆਨ ਰੱਖੀਏ ਆਪਾਂ ਥੋੜ੍ਹਾ ਜਾ ਨਾ ਬੱਚਿਆਂ ਨੂੰ ਵੀ ਆਪਣੇ ਸਿਖਾਈਏ ਆਹ ਚੀਜ਼ਾਂ ਵੱਲ ਅਵੇਅਰ ਕਰੀਏ ਵੀ ਤਾਂ ਕਿ ਬੱਚੇ ਵੀ ਇਹ ਚੀਜ਼ ਤੋਂ ਬਚ ਸਕਣ ਤਾਂ ਜਵਾਕ ਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ਾਂ ਬਾਰੇ ਥੋੜ੍ਹੀ ਗੌਰ ਕਰੀਏ ਥੋੜ੍ਹਾ ਆਪ ਆਪਣੀ ਚੀਜ਼ਾਂ ਨਾਲ ਹੈ ਨਾ ਆਪਾਂ ਆਪਣੀ ਜਾਨ ਬਚਾ ਸਕਦੇ ਹਾਂ ਕੁਛ ਕੁ ਚੀਜ਼ਾਂ ਕਰਕੇ ਤਾਂ ਕਿਉਂ ਨਹੀਂ ਪਰਵੀਸ਼ਨ ਇਜ਼ ਬੈਟਰ ਦੈੱਨ ਕਿਓਰ ਉਹ ਕਰਕੇ ਦੇਖੀਏ